ਸਾਡੇ ਇੱਥੇ ਸੈਰ ਸਪਾਟੇ ਲਈ ਬਹੁਤ ਸਾਰੇ ਲੋਕ ਆਉਂਦੇ ਹਨ ਕਿਉਂਕਿ ਸਾਡੇ ਇਲਾਕੇ ਵਿੱਚ ਸੈਰ ਸਪਾਟੇ ਲਈ ਬਹੁਤ ਸਾਰੀਆਂ ਜਗ੍ਹਾਵਾਂ ਜੋ ਕਿ ਸੈਲਾਨੀਆਂ ਲਈ ਦੇਖਣ ਵਾਲੀਆਂ ਹਨ ਜਿਵੇਂ ਕਿ ਸਾਡੇ ਇੱਥੇ ਸਭ ਤੋਂ ਪਹਿਲਾਂ ਅਸੀਂ ਗੱਲ ਕਰੀਏ ਕਿ ਮੁਕੇਸ਼ ਮੁਕਤੇਸ਼ਵਰ ਧਾਮ ਹੈ ਮੁਕਤੇਸ਼ਵਰ ਧਾਮ ਬਹੁਤ ਮੁਕਤੇਸ਼ਵਰ ਧਾਮ ਬਹੁਤ ਹੀ ਪੁਰਾਣਾ ਮੰਦਰ ਹੈ ਇੱਥੇ ਬਹੁਤ ਸਾਰੇ ਸ਼ਰਧਾਲੂ ਆਉਂਦੇ ਹਨ ਇੱਥੇ ਮੱਥਾ ਟੇਕਦੇ ਹਨ ਇੱਥੇ ਮੁਕਤੇਸ਼ਵਰ ਧਾਮ ਦੀਆਂ ਬਹੁਤ ਸਾਰੀਆਂ ਪੌੜੀਆਂ ਹਨ ਜਿਵੇਂ ਕਿ ਮੁਕਤੇਸ਼ਵਰ ਧਾਮ ਦੇ ਵਿੱਚ ਦਰਸ਼ਨ ਕਰਨ ਲਈ ਬਹੁਤ ਹੀ ਜ਼ਿਆਦਾ ਨੀਵੀਂ ਜਗ੍ਹਾ 'ਤੇ ਉਤਰਨਾ ਪੈਂਦਾ ਹੈ ਅਤੇ ਫਿਰ ਥੱਲੇ ਜਾ ਕੇ ਦਰਸ਼ਨ ਹੁੰਦੇ ਹਨ ਮੁਕਤੇਸ਼ਵਰ ਧਾਮ ਤੋਂ ਬਾਅਦ ਵਿੱਚ ਅਸੀਂ ਗੱਲ ਕਰਦੇ ਹਾਂ ਰਣਜੀਤ ਸਾਗਰ ਡੈਮ ਰਣਜੀਤ ਸਾਗਰ ਡੈਮ ਜੋ ਕਿ ਪੰਜਾਬ ਦਾ ਸਭ ਤੋਂ ਵੱਡਾ ਡਾ ਡੈਮ ਹੈ ਰਣਜੀਤ ਸਾਗਰ ਡੈਮ ਦੀਆਂ ਇਹ ਬਹੁਤ ਸਾਰੀਆਂ ਖੂਬੀਆਂ ਹਨ ਕਿਉਂਕਿ ਲਗਭਗ ਪੰਜਾਬ ਦੇ ਸਾਰੇ ਬਿਜਲੀ ਜੋ ਕਿ ਹੈ ਉਹ ਇੱਥੋਂ ਰਣਜੀਤ ਸਿੰਘ ਡੈਮ ਤੋਂ ਹੀ ਪੈਦਾ ਹੁੰਦੀ ਹੈ ਰਣਜੀਤ ਸਾਗਰ ਡੈਮ ਤੋਂ ਹੀ ਆਉਂਦੀ ਹੈ ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਕਿ ਪੰਜਾਬ ਵਿੱਚ ਬਹੁਤ ਹੀ ਜ਼ਿਆਦਾ ਮਤਲਬ ਇੱਥੇ ਪਠਾਨਕੋਟ ਵਿੱਚ ਬਹੁਤ ਹੀ ਜ਼ਿਆਦਾ ਸੈਲਾਨੀ ਜੋ ਕਿ ਆਉਂਦੇ ਹਨ ਇੱਥੇ ਬਹੁਤ ਸਾਰੇ ਪਾਰਕ ਵੀ ਬਣਾਏ ਜਾਂਦੇ ਹਨ ਜੋ ਕਿ ਸੈਲਾਨੀਆਂ ਨੂੰ ਬਹੁਤ ਜੀ ਵਧੀਆ ਲੱਗਦੇ ਹਨ ਅਤੇ ਜਿਵੇਂ ਕਿ ਅਸੀਂ ਗੱਲ ਕਰੀਏ ਕਿ ਹੁਣੇ ਹੁਣੇ ਜੋ ਕਿ ਮਿੰਨੀ ਗੋਆ ਸਥਾਨ ਜੋ ਕਿ ਆ ਉਹ ਖੁੱਲ੍ਹਿਆ ਹੈ ਇਹ ਹੁਣੇ ਹੁਣੇ ਨਵਾਂ ਹੀ ਬਣਿਆ ਇੱਥੇ ਵੋਟਿੰਗ ਵੀ ਕੀਤੀ ਜਾਂਦੀ ਹੈ ਇੱਥੇ ਬਹੁਤ ਜ਼ਿਆਦਾ ਜੋ ਕਿ ਪਰਯਟਕ ਆਉਂਦੇ ਹਨ ਅਤੇ ਇੱਥੋਂ ਦਾ ਖੂਬ ਆਨੰਦ ਮਾਣਦੇ ਹਨ ਅਤੇ ਹੋਰ ਵੀ ਬਹੁਤ ਸਾਰੀਆਂ ਇੱਥੇ ਜਗ੍ਹਾਵਾਂ ਜਿਵੇਂ ਕਿ ਬਣੀਆਂ ਜਾਂਦੀਆਂ ਹਨ ਨਵੇਂ ਪਾਰਕ ਬਣੇ ਹੁੰਦੇ ਆ ਬਹੁਤ ਵੱਡੇ ਵੱਡੇ ਰੈਸਟੋਰੈਂਟ ਓਪਨ ਹੋਏ ਹੁੰਦੇ ਹਨ ਇੱਥੇ ਖਾਣ ਪੀਣ ਦਾ ਖੁੱਲ੍ਹਾ ਪ੍ਰਬੰਧ ਹੈ ਇਹਨਾਂ ਰੈਸਟੋਰੈਂਟ ਵਿੱਚ ਜੋ ਇਹ ਬਹੁਤ ਹੀ ਵੱਡੇ ਰੈਸਟੋਰੈਂਟ ਹਨ ਇਹਨਾਂ ਦੀ ਇਹਨਾਂ ਦੇ ਨਾਲ ਦੇ ਰੈਸਟੋਰੈਂਟ ਹੋਰ ਵੀ ਵੱਡੀਆਂ ਵੱਡੀਆਂ ਕੰਪਨੀਆਂ ਰੈਸਟੋਰੈਂਟ ਜਿਹੜੀਆਂ ਹੋਰ ਵੀ ਜਗ੍ਹਾਵਾਂ 'ਤੇ ਖੁੱਲ੍ਹੇ ਹਨ ਅਤੇ ਇੱਥੇ ਬਹੁਤ ਹੀ ਜ਼ਿਆਦਾ ਸੈਲਾਨੀ ਆ ਕੇ ਇੱਥੇ ਖੂਬ ਆਨੰਦ ਮਾਉਂਦੇ ਹਾ ਮਾਣਦੇ ਹਨ